ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਸਰ ਆਪਣਾ ਸਰ ਜੀ ਤਿੰਨ ਤਿੰਨ ਸੈਸ਼ਨ ਲੱਗਦੇ ਆ ਜੀ ਇੱਕ ਸਵੇਰੇ ਅੱਠ ਵਜੇ ਹਾਂਜੀ ਦੂਸਰਾ ਆਪਣਾ ਦੋ ਵਜੇ ਲੱਗਦਾ ਜੀ ਦੋ ਤੋਂ ਚਾਰ ਅਤੇ ਤੀਸਰਾ ਆਪਣੇ ਛੇ ਤੋਂ ਅੱਠ ਜੀ ਲੱਗਦਾ ਜੀ ਹਾਂਜੀ ਆਪਣੇ ਸਰ ਹਾਂਜੀ ਤੁਸੀਂ ਤੁ ਤੁਸੀਂ ਕਹੋਗੇ ਤਾਂ ਮੈਂ ਕਰ ਦੂੰਗਾ ਤੁਹਾਡੇ ਹਜ਼ਾਰ ਕਰ ਦੂੰਗਾ ਅਤੇ ਸਰ ਅ ਮੈਕਸੀਮਮ ਤੁਹਾਨੂੰ ਸ਼ ਬੋਡੀ ਕਿੱਦਾਂ ਦੀ ਹੈ ਫਿਰ ਬੋਡੀ ਹਿਸਾਬ 'ਤੇ ਆਪਾਂ ਨੂੰ ਫਿਰ ਉਹ ਹਿਸਾਬ ਸੇ ਟਾਈਮ ਲੱਗਦਾ ਜੀ ਜਲ ਮਲ ਹ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਇੱਕ ਕਪਾਲਭਾਤੀ ਅਤੇ ਸੂਰਿਆ ਆਸਨ ਹਾਂਜੀ ਅਤੇ ਆਪਣਾ ਮ੍ਰਿਤ ਆਸਨ ਧਨੁਸ਼ ਆਸਨ ਇਹ ਤੁਹਾਡੇ 'ਤੇ ਪਰਫੈਕਟ ਰਹਿਣਗੇ ਜੀ ਫੇ ਇਹ ਡੇਲੀ ਕਰੋਗੇ ਹਾਂਜੀ ਹਾਂਜੀ ਹਾਂਜੀ ਕਰ ਦਾਂਗੇ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕਿੰਨੇ ਤੋਂ ਕਿੰਨੇ ਤੱਕ ਜਾਂਦੇ ਹੋ ਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਠੀਕ ਹੈ ਸਰ ਮੰਨ ਲਓ ਤੁਸੀਂ ਚਾਰ ਤੋਂ ਚਾਰ ਵਜੇ ਤੋਂ ਲੈ ਕੇ ਛੇ ਵਜੇ ਤੱਕ ਕਰ ਸਕਦੇ ਹੋ ਹਾਂਜੀ ਉਹ ਕਰਵਾ ਦਾਂਗੇ ਜੀ ਹਾਂਜੀ ਹੋਰ ਦੱਸੋ ਜੀ ਆਪਣੇ ਬੈਜ ਇਕ ਵੀਹ ਬੈ ਹੁੰਦੇ ਆ ਜੀ ਹਾਂਜੀ ਲੇਡੀਜ ਵੀ ਹੁੰਦੇ ਵਿੱਚ ਜੀ ਇਕੱਠੇ ਹੁੰਦੇ ਜੀ ਸਾਰੇ ਹਾਂਜੀ

ਹਾਂਜੀ ਤੁਹਾਡਾ ਵਾਸਤੇ ਕਰ ਦਾਂਗੇ ਤੁਹਾਨੂੰ ਤੁਹਾ ਹਾਂਜੀ ਹਾਂਜੀ ਤੁਹਾਨੂੰ ਲੈਸ ਕਰ ਦਾਂਗੇ ਹੌਰ ਦੋ ਸੌ ਲੈਸ ਕਰ ਦਾਂਗੇ ਹਜ਼ਾਰ ਵਿੱਚੋਂ

ਬਾਕੀਆਂ ਦਾ ਹਜ਼ਾਰ ਲਗਾ ਦਾਂਗੇ ਜਿਵੇਂ ਆਪਣਾ ਹੁਣ ਪੰਦਰਾਂ ਸੌ ਰੇਟ ਚਲਦਾ ਜੀ ਠੀਕ ਆ ਜੀ ਮਹੀਨਾ ਤੁਹਾਡੇ ਵਾਸਤੇ ਪਹਿਲਾਂ ਹਜ਼ਾਰ ਕਰਤਾ ਸੀ ਹੁਣ ਅੱਠ ਸੌ ਕਰ ਦਾਂਗੇ ਅਤੇ ਉਹਨਾਂ ਹਜ਼ਾਰ ਰੁਪਇਆ ਲੈ ਲਾਂਗੇ ਤੁਸੀਂ ਕਰ ਸਕਦੇ ਪਰਸੋਂ ਤੋਂ ਜੁਆਇਨ ਕਰ ਸਕਦੇ ਹੋ ਜੀ ਹਾਂਜੀ ਨਹੀਂ ਬਸ ਸੰਡੇ ਛੁੱਟੀ ਹੁੰਦੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਥੈਂਕ ਯੂ ਵੈਰੀ ਮਚ ਓਕੇ ਓਕੇ ਜੀ